ਪਿਛਲੇ ਦਿਨ ਹੀ ਮੈਂ ਸਕੂਟਰ ਮਾਰਕੀਟ ਦੇ ਵਿੱਚ ਇੱਕ ਪੁਰਾਣਾ ਮੋਟਰਸਾਈਕਲ ਲੈਣ ਲੈ ਲਿਆ ਲੈਣ ਦੀ ਗਲਤੀ ਵੀ ਕਰ ਗਿਆ ਜਦੋਂ ਮੈਂ ਲੈ ਰਿਹਾ ਸੀ ਤਾਂ ਜੋ ਦੁਕਾਨਦਾਰ ਸੀ ਉਹਨੇ ਮੈਨੂੰ ਮੋਟਰਸਾਈਕਲ ਦੀਆਂ ਬੜੀਆਂ ਹੀ ਸਿਫਤਾਂ ਦੱਸੀਆਂ ਕਿ ਇਹ ਬਿਲਕੁਲ ਨਵੇਂ ਵਰਗਾ ਹੈ ਇਹਦੀ ਫਿਨਿਸ਼ਿੰਗ ਬੜੀ ਅੱਛੀ ਹੈ ਇਹਦੀ ਐਵਰੇਜ ਬੜੀ ਅੱਛੀ ਹੈ ਇਹ ਤਾਂ ਪਹਿਲੀ ਕਿੱਕ 'ਤੇ ਸਟਾਰਟ ਹੋ ਜਾਂਦਾ ਹੈ ਇਹਦਾ ਇੰਜਨ ਬਿਲਕੁਲ ਓਕੇ ਆ ਪਰ ਹਫਤੇ ਦਸ ਦਿਨ ਬਾਅਦ ਹੀ ਉਹ ਸਕੂਟਰ ਪੁਰਾਣੇ ਲਏ ਸਕੂਟਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਬਾਰ ਬਾਰ ਬੰਦ ਹੋ ਰਿਹਾ ਸੀ ਪਲੱਗ ਉਸਦਾ ਸ਼ੋਟ ਹੋ ਰਿਹਾ ਸੀਗਾ ਮੇਰੇ ਖਿਆਲ ਵਿੱਚ ਇੱਕ ਦੋ ਜਗ੍ਹਾ ਤੋਂ ਉਸਦਾ ਰੰਗ ਵੀ ਉਤਰ ਗਿਆ ਸੀ ਤਾਂ ਜੋ ਸੈਕਿੰਡ ਹੈਡ ਪ੍ਰੋਡਕਟ ਆ ਮੇਰਾ ਉਸ ਦੇ ਬਾਰੇ ਬੜਾ ਹੀ ਨੈਗਟਿਵ ਬਹੁਤ ਜ਼ਿਆਦਾ ਕੀਤਾ ਬੜਾ ਪਰੇਸ਼ਾਨ ਹੋ ਰਿਹਾ ਸੀ ਡਿਊਟੀ 'ਤੇ ਟਾਈਮ ਸਿਰ ਪਹੁੰਚਣਾ ਹੁੰਦਾ ਰਸਤੇ 'ਚ ਖਰਾਬ ਹੋ ਰਿਹਾ ਸੀ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਕੇ ਬੜਾ ਅਜੀਬ ਜਿਹਾ ਲੱਗਿਆ ਤਾਂ ਮੇਰੇ ਮਨ ਵਿੱਚ ਇਹੀ ਆਇਆ ਕਿ ਇਹ ਸੈਕਿੰਡ ਹੈਂਡ ਪ੍ਰੋਡਕਟ ਲੈ ਕੇ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਅਤੇ ਜਲਦੀ ਉਸ ਨੂੰ ਮੈਂ ਦੁਬਾਰਾ ਰੀਸੇਲ ਕਰ ਦਿੱਤਾ ਹੁਣ ਮੈਂ ਜੋ ਵੀ ਪ੍ਰੋਡਕਟ ਲਵਾਂਗਾ ਨਵਾਂ ਹੀ ਲਵਾਂਗਾ ਜੀ